ਪੰਜਾਬ ਵਿੱਚ ਵੱਖ ਵੱਖ ਪ੍ਰਕਾਰ ਦੇ ਧਰਮ ਅਭਿਆਸ ਕੀਤੇ ਜਾਂਦੇ ਹਨ ਹਿੰਦੂ ਧਰਮ ਅਤੇ ਸਿੱਖ ਧਰਮ ਉਹਨਾਂ ਵਿੱਚੋਂ ਮੇਜਰ ਧਰਮ ਨੇ ਇਹ ਦੋਨਾਂ ਧਰਮਾਂ ਨੇ ਗਰੀਬੀ ਅਤੇ ਸਮਾਜ ਸੁਧਾਰ ਨੂੰ ਬਹੁਤ ਹੀ ਚੰਗੀ ਤਰ੍ਹਾਂ ਸੰਬੋਧਿਤ ਕੀਤਾ ਗੁਰਦੁਆਰਿਆਂ ਵਿੱਚ ਤਾਂ ਲੰਗਰ ਲੱਗੇ ਹੀ ਰਹਿੰਦੇ ਹਨ ਜੋ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦਿੰਦੇ ਇਨ੍ਹਾਂ ਲੰਗਰਾਂ ਵਿੱਚ ਇੱਡਾ ਵਧੀਆ ਖਾਣਾ ਮਿਲਦਾ ਹੈ ਕਿ ਕੋਈ ਸੋਚ ਵੀ ਨਹੀਂ ਸਕਦਾ ਅਤੇ ਜਿਹੜੇ ਦਾਨ ਵਗੈਰਾ ਮੰਦਰਾਂ ਵਿੱਚ ਜਾਂਦੇ ਹਨ ਉਹਨਾਂ ਨੂੰ ਵੀ ਗਰੀਬਾਂ ਦੀ ਭਲਾਈ ਵਿੱਚ ਯੂਜ ਕੀਤਾ ਜਾਂਦਾ ਹੈ ਹਿੰਦੂ ਧਰਮ ਅਤੇ ਸਿੱਖ ਧਰਮ ਦੀ ਅਲੱਗ ਅਲੱਗ ਸੰਸਥਾਵਾਂ ਵੀ ਹੈਗੀਆਂ ਹਨ ਜਿਹੜੇ ਕਿ ਸਮਾਜ ਸੁਧਾਰ ਅਤੇ ਗਰੀਬੀ ਨੂੰ ਹਟਾਉਣ ਲਈ ਕੰਮ ਕਰਦੇ ਹਨ ਖਾਲਸਾ ਏਡ ਪੀ ਐਫ ਏ ਅਲੱਗ ਅਲੱਗ ਸੰਸਥਾਵਾਂ ਦੇ ਨਾਮ ਹਨ ਇਹ ਸੰਸਥਾਵਾਂ ਸਾਨੂੰ ਦੱਸਦੀਆਂ ਹਨ ਕਿ ਜੇ ਧਰਮ ਦਾ ਸਹੀ ਮਤਲਬ ਧਰਮ ਦਾ ਸਹੀ ਮਤਲਬ ਕੋਈ ਸਮਝੇ ਤਾਂ ਦੁਨੀਆ ਕਿਸ ਤਰ੍ਹਾਂ ਨਾਲ ਬਦਲ ਸਕਦੀ ਆ ਖਾਲਸਾ ਏਡ ਵਿੱਚ ਇੱਕ ਉਹ ਐਨ ਜੀ ਓ ਹੈ ਜੋ ਕਿ ਗਰੀਬ ਬੱਚਿਆਂ ਨੂੰ ਪੜਾਉਂਦਾ ਹੈ ਅਤੇ ਔਰ ਵੀ ਸੰਸਥਾਵਾਂ ਹੈਗੀਆਂ ਹਨ ਜਿਹੜੀਆਂ ਰੱਬ ਦੇ ਨਾਂ 'ਤੇ ਪੈਸੇ ਲੈ ਕੇ ਚੰਗੀ ਜਗ੍ਹਾ 'ਤੇ ਲਾਉਂਦੀਆਂ ਹਨ ਚੰਗੀ ਜਗ੍ਹਾ ਯਾਨੀ ਕਿ ਗਰੀਬੀ ਨੂੰ ਦੂਰ ਕਰਨ ਲਈ ਭੁੱਖਿਆਂ ਦਾ ਭੇਟ ਭਰਨ ਲਈ ਐਟ ਸੈਟਰਾ ਸ਼ਕਤੀਕਰਨ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਆਰ ਐਸ ਐਸ ਆਰ ਐਸ ਐਸ ਵੀ ਇੱਕ ਉਸ ਤਰ੍ਹਾਂ ਦੀ ਸੰਸਥਾ ਹੈ